ਯੋਗਾ ਸਿਰਫ਼ ਕਸਰਤ ਦਾ ਹੀ ਇੱਕ ਰੂਪ ਨਹੀਂ ਹੈ ਇਹ ਬਹੁਤ ਵਧੀਆ ਜੇ ਆਪਾਂ ਨਿਰੰਤਰ ਯੋਗਾ ਕਰਦੇ ਹਾਂ ਅਤੇ ਇੱਕ ਤਾਂ ਹੈ ਸਾਡਾ ਸਰੀਰ ਨੂੰ ਕੋਈ ਵੀ ਬਿਮਾਰੀ ਅਟਰੈਕਟ ਕਰਦੇ ਕੋਈ ਬਿਮਾਰੀ ਨਹੀਂ ਲੱਗਦੀ ਜਦੋਂ ਆਪਾਂ ਨਿਰੰਤਰ ਰੋਜ਼ ਆਪਾਂ ਯੋਗਾ ਕਰਾਂਗੇ ਜਿਸ ਤਰ੍ਹਾਂ ਆਪਾਂ ਇਕ ਘੰਟਾ ਨਿਕਾਲ ਲਈਏ ਅਤੇ ਯੋਗਾ ਕਰੀਏ ਇੱਕ ਤਾਂ ਸਾਡਾ ਸਟੈਮਿਨਾ ਵਧਦਾ ਹੈ ਇਕ ਮੈਡੀਟੇਸ਼ਨ ਦੀ ਆਦਤ ਪੈਂਦੀ ਹੈ ਇੱਕ ਸਾਡੀ ਬੋਡੀ ਬਹੁਤ ਜ਼ਿਆਦਾ ਫਲੈਕਸੀਬਲ ਰਹਿੰਦੀ ਹੈ ਅਤੇ ਬਹੁਤ ਜ਼ਿਆਦਾ ਥੱਕਦੀਆਂ ਨਹੀਂ ਹੈਗੇ ਅਤੇ ਸਾਡੀ ਸਾਨੂੰ ਕਿਸੇ ਦਵਾਈਆਂ ਦੀ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਬਿਕੋਜ਼ ਸਾਡੀ ਜਿਹੜਾ ਸਰੀਰ ਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਯੋਗਾ ਸਾਡਾ ਬਹੁਤ ਜ਼ਿਆਦਾ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਜੋ ਕਿ ਕਿਸੇ ਵੀ ਚੀਜ਼ ਨੂੰ ਸਾਡੇ ਲਾਗੇ ਨਹੀਂ ਬਿਮਾਰੀਆਂ ਨੂੰ ਲਾਗੇ ਨਹੀਂ ਲੱਗਣ ਦਿੰਦੀ ਅਤੇ ਯੋਗਾ ਦਾ ਬਹੁਤ ਜ਼ਿਆਦਾ ਫ਼ਾਇਦਾ ਹੈਗਾ ਯੋਗਾ ਇੱਕ ਸਿਰਫ਼ ਕਸਰਤ ਨਹੀਂ ਗਿਣੀ ਜਾਂਦੀ ਸਿਰਫ਼ ਇੱਕ ਕਸਰਤ ਨਹੀਂ ਹੈ ਇਹ ਯੋਗਾ ਸਾਨੂੰ ਇੱਕ ਸਾਧਨਾ ਲਗਾਉਣ ਵਾਸਤੇ ਵੀ ਬਹੁਤ ਯੋਗਾ ਰੂਟੀਨ ਬੇਸਿਸ 'ਤੇ ਕਰਾਂਗੇ ਤਾਂ ਆਪਾਂ ਸਾਧਨਾ ਬਹੁਤ ਈਜ਼ੀਲੀ ਕਰ ਸਕਦੇ ਹਾਂ ਬਿਕੋਜ਼ ਸਾਡੇ ਸਰੀਰ ਨੂੰ ਉਸ ਤਰ੍ਹਾਂ ਦੀ ਹੈਵਿਚਅਲ ਆਦਤ ਪੈ ਜਾਂਦੀ ਹੈ ਅਤੇ ਆਪਾਂ ਮੈਡੀਟੇਸ਼ਨ ਆਪਣੇ ਸਾਧਨਾ ਬਹੁਤ ਹੀ ਈਜ਼ੀਲੀ ਲਾ ਸਕਦੇ ਹਾਂ ਅਤੇ ਸਾਡੇ ਸਰੀਰ ਨੂੰ ਫਿਟ ਐਂਨ ਫਾਈਨ ਅਤੇ ਬਿਲਕੁਲ ਬਿਮਾਰੀਆਂ ਤੋਂ ਨਿਰੁਕਤ ਅਤੇ ਪਰੇ ਰੱਖਦੀ ਹੈ ਸਾਨੂੰ ਕੋਈ ਵੀ ਦਵਾਈ ਦੀ ਨਹੀਂ ਲੋੜ ਪੈਂਦੀ ਸਾਡੇ ਸਰੀਰ ਨੂੰ ਕਦੇ ਵੀ ਥਕਾਵਟ ਮਹਿਸੂਸ ਨਹੀਂ ਹੁੰਦੀ ਤਾਂ ਸਰੀਰ ਸਾਡਾ ਬਹੁਤ ਫਿੱਟ ਰਹਿੰਦਾ